ਹਾਂਜੀ ਮੈਂ ਬਿਜਲੀ ਦੇ ਖਤਰਿਆਂ ਤੋਂ ਜਾਣੂ ਹਾਂ ਅੱਜ ਕੱਲ੍ਹ ਬਿਜਲੀ ਆਪਣੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਈ ਆ ਹਰ ਚੀਜ਼ ਚਾਹੇ ਫੋਨ ਹੋਵੇ ਚਾਹੇ ਟੀ ਵੀ ਹੋਵੇ ਚਾਹੇ ਰੈਫਰੀਜੀਰੇਟਰ ਹੋਣ ਓਵਨ ਹੋਵੇ ਕਿਚਨ ਵਿੱਚ ਮਿਕਸੀ ਜੂਸਰ ਕੁਛ ਵੀ ਇਹ ਸਾਰੀਆਂ ਚੀਜ਼ਾਂ ਕੀ ਆ ਬਿਜਲੀ ਦੇ ਉਪਕਰਣ ਹਨ ਅਤੇ ਬਿਜਲੀ ਨਾਲ ਹੀ ਇਹ ਚੱਲਦੇ ਹਨ ਬਿਜਲੀ ਦਾ ਖਤਰਾ ਆਪਾਂ ਨੂੰ ਅਕਸਰ ਇਨਾਂ ਬਿਜਲੀ ਦੇ ਉਪਕਰਣਾਂ ਤੋਂ ਹੀ ਹੁੰਦਾ ਏ ਇਸ ਤੋਂ ਇਲਾਵਾ ਆਪਾਂ ਨੂੰ ਬਿਜਲੀ ਦਾ ਖ਼ਤਰਾ ਜਿਹੜਾ ਏ ਆਪਾਂ ਨੂੰ ਜਿਵੇਂ ਖ਼ਰਾਬ ਮੌਸਮ ਹੁੰਦਾ ਥੰਡਰਿੰਗ ਹੁੰਦੀ ਆ ਲਾਈਟਨਿੰਗ ਹੁੰਦੀ ਆ ਉਦੋਂ ਵੀ ਆਪਾਂ ਨੂੰ ਬਿਜਲੀ ਦਾ ਖ਼ਤਰਾ ਬਣ ਸਕਦਾ ਹੈ ਤਾਂ ਬਿਜਲੀ ਤੋਂ ਬਿਜਲੀ ਦੇ ਖ਼ਤਰਿਆਂ ਤੋਂ ਹਮੇਸ਼ਾਂ ਜਾਣੂ ਰਹੀਏ ਸਾਰਿਆਂ ਨਾਲੋਂ ਪਹਿਲਾਂ ਬਚਣ ਲਈ ਤਾਂ ਪ ਬਚਣ ਲਈ ਇਹ ਜ਼ਰੂਰੀ ਹੈ ਕਿ ਆਪਾਂ ਨੂੰ ਬਿਜਲੀ ਦੇ ਖ਼ਤਰਿਆਂ ਬਾਰੇ ਪਤਾ ਹੋਵੇ ਬਿਜਲੀ ਦੇ ਖ਼ਤਰਿਆਂ ਤੋਂ ਬਚਣ ਲਈ ਹਮੇਸ਼ਾਂ ਨੰਗੇ ਪੈਰੀਂ ਨੰਗੇ ਪੈਰੀਂ ਨਾ ਹੋਈਏ ਕਿਉਂਕਿ ਕਈ ਵਾਰ ਕੀ ਹੁੰਦਾ ਏ ਬਿਜਲੀ ਦੇ ਉਪਕਰਣ ਜਾਂ ਫਿਰ ਐਪਲਾਈਸਿੰਸ ਜਿਹੜੇ ਕਿ ਆ ਇਹਨਾਂ ਦੀ ਕੋਈ ਤਾਰ ਵਗੈਰਾ ਕਰੈਕ ਹੁੰਦੀ ਹੈ ਜਾਂ ਫਿਰ ਨੰਗੀ ਤਾਰ ਨੂੰ ਆਪਾਂ ਹੱਥ ਪਾ ਲੈਂਦੇ ਹਾਂ ਜੇ ਆਪਾਂ ਨੰਗੇ ਪੈਰ ਹੋਵਾਂਗੇ ਤਾਂ ਆਪਾਂ ਨੂੰ ਝਟਕਾ ਉੰਨਾਂ ਹੀ ਜ਼ੋਰ ਦਾ ਲੱਗੇਗਾ ਇਸ ਲਈ ਹਮੇਸ਼ਾਂ ਆਪਾਂ ਧਿਆਨ ਰੱਖੀਏ ਕਿ ਹਮੇਸ਼ਾਂ ਨੰਗੇ ਪੈਰ ਨਾ ਹੋਈਏ ਉੱਤੋਂ ਆਪਣੇ ਹੱਥ ਵੀ ਹੱਥ ਵੀ ਹਮੇਸ਼ਾਂ ਆਪਣੇ ਸੁੱਕੇ ਹੋਣ ਗਿੱਲੇ ਹੱਥਾਂ ਨਾਲ ਜੇ ਆਪਾਂ ਕਿਸੇ ਵੀ ਬਿਜਲੀ ਵਾਲੀ ਚੀਜ਼ ਦਾ ਆਪਾਂ ਵਰਤੋਂ ਕਰਾਂਗੇ ਤਾਂ ਉੰਨਾਂ ਹੀ ਜ਼ਿਆਦਾ ਝਟਕਾ ਆਵੇਗਾ ਇਹ ਹਮੇਸ਼ਾਂ ਆਪਾਂ ਧਿਆਨ ਰੱਖਣਾ ਹੈ ਇਸ ਤੋਂ ਇਲਾਵਾ ਆਪਾਂ ਬੱਚਿਆਂ ਨੂੰ ਵੀ ਪੂਰਾ ਚੰਗੀ ਤਰ੍ਹਾਂ ਗਾਈਡ ਕਰਨਾ ਹੈ ਜਿਵੇਂ ਕੋਈ ਵੱਡਾ ਕੋਈ ਕੋਲ ਹੋਵੇਗਾ ਤਾਂ ਹੀ ਉਹ ਬਿਜਲੀ ਦੀ ਕੋਈ ਚੀਜ਼ ਵਰਤਣ ਜਿਵੇਂ ਬੱਚੇ ਫੋਨ ਵਗੈਰਾ ਜਾਂ ਫਿਰ ਟੀ ਵੀ ਵਗੈਰਾ ਯੂਸ ਕਰਦੇ ਆ ਤਾਂ ਕਰਕੇ ਉਹਨਾਂ ਨੂੰ ਆਪਾਂ ਗਾਈਡ ਕਰ ਦੇਈਏ ਤਾਂ ਕਿ ਉਹਨਾਂ ਦੇ ਕੋਈ ਵੀ ਖ਼ਤਰਾ ਨਾ ਹੋਵੇ ਇਸ ਤਰਾਂ ਆਪਾਂ ਅੱਡ ਅੱਡ ਤਰੀਕੇ ਨਾਲ ਬਿਜਲੀ ਅਤੇ ਝਟ ਬਿਜਲੀ ਦੇ ਖ਼ਤਰਿਆਂ ਤੋਂ ਆਪਾਂ ਬਚ ਸਕਦੇ ਹਾਂ